ਵਧੀਆ ਪ੍ਰਸ਼ਨ ਹੈ ਭਾਈ ਕਿਵੇਂ ਪਤਾ ਲੱਗਿਆ ਕਿਵੇਂ ਪਤਾ ਲੱਗਿਆ ਇਹ ਤਾਂ ਬੜੇ ਰੀਜ਼ਨ ਨੇ ਸਭ ਤੋਂ ਵਧੀਆ ਤਾਂ ਤੁਹਾਡਾ ਯੂਟੀਊਬ ਹੀ ਹੈ ਅਗਰ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਹਿੰਦੁਸਤਾਨ ਤੋਂ ਪੰਜਾਬ ਦੇ ਵਾਸੀ ਹਾਂ ਪੰਜਾਬ ਤੋਂ ਲੁਧਿਆਣੇ ਦੇ ਵਾਸੀ ਹਾਂ ਬਟ ਯੂਟੀਊਬ ਯੂਟੀਊਬ ਤਾਂ ਹਰ ਮੰਚ ਨੂੰ ਲੈ ਕੇ ਵਿਕਸਿਤ ਹੈ ਇਸ ਕਰਕੇ ਇਹ ਚੀਜ਼ਾਂ ਆਮ ਹੀ ਨੇ ਬਟ ਇਸ ਤੋਂ ਵੀ ਇਲਾਵਾ ਇਸ ਤੋਂ ਵੀ ਇਲਾਵਾ ਕਈ ਨੇ ਅਸੀਂ ਸ਼ਿਮਲੇ ਗਏ ਕੁਫਰੀ ਗਏ ਉੱਥੇ ਦੇਖਣ ਨੂੰ ਮਿਲਦੀ ਹੈ ਆਮ ਇਧਰ ਸ਼੍ਰ ਆਪਣਾ ਸ਼੍ਰੀਨਗਰ ਚਲੇ ਜਾਓ ਇਸ ਤੋਂ ਇਲਾਵਾ ਮੈਂ ਕਨੇਡਾ ਦੋ ਤਿੰਨ ਵਾਰੀ ਗਿਆ ਹਾਂ ਉੱਥੇ ਵੀ ਕੁਛ ਇਹੋ ਜਿਹੀਆਂ ਥਾਵਾਂ 'ਤੇ ਅਸੀਂ ਗਏ ਹਾਂ ਜਿੱਥੇ ਪ੍ਰੋਫੈਸ਼ਨਲੀ ਪ੍ਰੋਫੈਸ਼ਨਲ ਤੌਰ 'ਤੇ ਬਿਜਨਸ ਤੌਰ 'ਤੇ ਵੀ ਇਹ ਗੇਮਾਂ ਚੱਲਦੀਆਂ ਰਹਿੰਦੀਆਂ ਨੇ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਪਤਾ ਲੱਗਣਾ ਕੋਈ ਵੱਡੀ ਗੱਲ ਨਹੀਂ ਹੈ ਇਥੋਂ ਤੱਕ ਕਿ ਅਸੀਂ ਤਾਂ ਖੇਡਣ ਲਈ ਵੀ ਟਰਾਈ ਕਰ ਚੁੱਕੇ ਹਾਂ ਪਰ ਡਿੱਗ ਕੇ ਆ ਜਾਈਦਾ ਇਸ ਕਰਕੇ ਕੋਈ ਇੰਨੀ ਵੱਡੀ ਗੱਲ ਨਹੀਂ ਹੈ ਅੱਜ ਕੱਲ੍ਹ ਹਰ ਚੀਜ਼ ਦਾ ਪਤਾ ਲਗਾਉਣਾ ਗੂਗਲ ਹੈ ਯੂਟੀਊਬ ਹੈ ਤੁਹਾਡਾ ਫੇਰਾ ਤੋਰਾ ਹੈ ਕਿਤੇ ਇੱਧਰ ਉੱਧਰ ਵੀ ਜਾਂਦੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਇਹਨਾਂ ਚੀਜ਼ਾਂ ਬਾਰੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਮ ਕਈ ਹੋਰ ਮੰਚ ਨੇ ਦੇਖਣ ਲਈ ਇਹਨਾਂ ਚੀਜ਼ਾਂ ਨੂੰ ਬਾਕੀ ਕਨੇਡਾ ਇੱਧਰ ਚਲੇ ਗਏ ਸ਼ਿਮਲੇ ਚਲੇ ਗਏ ਏ ਸ਼੍ਰੀਨਗਰ ਜੰਮੂ ਕਸ਼ਮੀਰ ਦੇ ਵਿੱਚ ਚਲੇ ਜਾਓ ਹਿੰਦੁਸਤਾਨ 'ਚ ਵੀ ਕਈ ਹ ਐਸੀਆਂ ਸਟੇਟਾਂ ਨੇ ਜਿਹੜੀਆਂ ਕਿ ਨੋਰਮਲ ਇਸ ਗੇਮ ਨੂੰ ਖੇਡਣ ਲਈ ਬਹੁਤ ਵਧੀਆ ਪਲੇਸਿਸ ਨੇ ਅਤੇ ਬਹੁਤ ਵਧੀਆ ਤਾਂ ਕਰਕੇ ਪਤਾ ਲੱਗ ਜਾਂਦਾ ਬਾਕੀ ਅੱਜ ਕੱਲ੍ਹ ਇੰਟਰਨੈਟ ਤਾਂ ਬਹੁਤ ਕੁਝ ਸਿਖਾਉਂਦਾ ਜੀ